ਕੀ ਲਾਉਣਾ ਹੈ ਅਤੇ ਕਦੋਂ ਲਾਉਣਾ ਹੈ ਇਸ ਚੀਜ਼ ਦਾ ਫੈਸਲਾ ਮੈਂ ਕਾਫੀ ਸੋਚ ਵਿਚਾਰ ਕੇ ਕਰਦਾ ਹਾਂ ਇਸ ਦੇ ਲਈ ਮੈਂ ਆਪਣੇ ਦੋਸਤਾਂ ਨਾਲ ਪਰਿਵਾਰ ਮੈਂਬਰਾਂ ਨਾਲ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕਰ ਲੈਂਦਾ ਹਾਂ ਉਹਨਾਂ ਦੇ ਸਲਾਹ ਅਤੇ ਮਸ਼ਵਰਿਆਂ ਦਾ ਖ਼ਾਸ ਤੌਰ 'ਤੇ ਧਿਆਨ ਰੱਖਦਾ ਹਾਂ ਇਸ ਤੋਂ ਇਲਾਵਾ ਮੈਂ ਇਸ ਚੀਜ਼ ਦਾ ਵੀ ਧਿਆਨ ਰੱਖਦਾ ਹਾਂ ਕਿ ਇਸ ਦਾ ਮੇਰੀ ਜੇਬ ਉੱਤੇ ਵਧੇਰੇ ਬੋਝ ਨਾ ਪਵੇ ਜਿਹੜੀ ਵੀ ਚੀਜ਼ ਲਾਉਣੀ ਹੈ ਉਸ ਦੀਆਂ ਮਾਰਕੀਟ ਦੇ ਵਿੱਚ ਕਿੰਨੀਆਂ ਵਰਾਇਟੀਜ਼ ਹਨ ਅਤੇ ਕਿਸ ਕਿਸ ਰੂਪ ਦੇ ਵਿੱਚ ਉਹ ਉਪਲਬਧ ਹੈ ਇਸ ਚੀਜ਼ ਦਾ ਵੀ ਮੈਂ ਧਿਆਨ ਰੱਖਦਾ ਹਾਂ ਇਸ ਤੋਂ ਇਲਾਵਾ ਉਹ ਚੀਜ਼ ਮੇਰੇ ਲਈ ਕਿਸ ਰੂਪ ਵਿੱਚ ਫਾਇਦੇਮੰਦ ਹੈ ਅਤੇ ਕਿਸ ਰੂਪ ਦੇ ਵਿੱਚ ਨੁਕਸਾਨਦੇਹ ਇਸ ਦਾ ਫੈਸਲਾ ਮੈਂ ਪਹਿਲਾਂ ਹੀ ਸੋਚ ਵਿਚਾਰ ਲੈਂਦਾ ਹਾਂ ਅਗਰ ਉਹ ਚੀਜ਼ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਮੈਂ ਆਪਣਾ ਉਸ ਚੀਜ਼ ਨੂੰ ਲਗਾਉਣ ਦਾ ਫੈਸਲਾ ਲੈਂਦਾ ਹਾਂ ਨਹੀਂ ਤਾਂ ਮੈਂ ਉਸ ਚੀਜ਼ ਨੂੰ ਕਦੇ ਵੀ ਨਹੀਂ ਲਵਾਉਂਦਾ